ਹਾਂਜੀ ਕੋਚ ਸਾਹਿਬ ਬੋਲ ਰਹੇ ਜੀ ਕੋਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਹਾਂ ਹਾਂ ਮੇਰਾ ਮੇਰੇ ਕੋਲ ਹਾਂਜੀ ਮੈਨੂੰ ਦਿੱਤਾ ਸੀਗਾ ਤੁਹਾਡਾ ਨੰਬਰ ਹਾਂਜੀ ਹਾਂਜੀ ਹੋਰ ਦੱਸੋ ਠੀਕ ਠਾਕ ਹੋ ਹਾਂ ਹਾਂਜੀ ਗੇਮ ਕਰਦੇ ਹੈ ਜੀ ਹਾਂ ਸ਼ਾਮ ਨੂੰ ਕਰਦੇ ਹੈਗੇ ਜੀ ਸਾਢੇ ਛੇ ਤੋਂ ਰਾਤ ਦੇ ਸਾਢੇ ਅੱਠ ਵਜੇ ਤੱਕ ਦੋ ਘੰਟੇ ਗੇਮ ਕਰੀ ਦੀ ਹੈ ਜੀ ਹਾਂਜੀ ਹਾਂਜੀ ਹਾਂਜੀ ਧੰਨਵਾਦ ਜੀ ਐਕਟੀਵਿਟੀਆਂ ਪਹਿਲਾਂ ਨਾ ਨਾ ਨਾ ਨਾ ਨਾ ਨਾ ਪਹਿਲਾਂ ਵਾਰਮ ਅੱਪ ਕਰਦੇ ਹਾਂ ਜੀ ਹਾਂਜੀ ਪਹਿਲਾਂ ਵਾਰਮ ਅੱਪ ਕਰਦੇ ਹਾਂ ਸਟ੍ਰੈਚਿੰਗ ਸਟਰੁਚਿੰਗ ਕਰ ਕੇ ਅਤੇ ਵਾਰਮ ਅੱਪ ਕਰਦੇ ਹਾਂ ਗੇ ਵੀਹ ਤੋਂ ਪੱਚੀ ਮਿੰਟ ਪਹਿਲਾਂ ਵੀਹ ਤੋਂ ਪੱਚੀ ਮਿੰਟ ਵਾਰਮ ਅੱਪ ਕਰ ਕੇ ਅਤੇ ਫਿਰ ਗੇਮ ਸ਼ੁਰੂ ਕਰਦੇ ਹਾਂ ਜੀ ਫਿਰ ਗੇਮ ਲਾਉਂਦੇ ਹਾਂ ਜੀ ਚਾਲੀ ਮਿੰਟ ਚਾਲੀ ਮਿੰਟ ਗੇਮ ਬਾਸਕਿਟਬਾਲ ਜੀ ਬਾਸਕਿਟਬਾਲ ਖੇਡਦੇ ਹਾਂ ਹਾਂਜੀ ਹਾਂਜੀ ਹੋ ਗਏ ਜੀ ਪੰਦਰਾਂ ਸੋਲਾਂ ਸਾਲ ਹੋ ਗਏ ਜੀ ਖੇਡਦਿਆਂ ਹਾਂਜੀ ਹਾਂ ਸਾਡਾ ਹੈਗਾ ਜੀ ਨਹੀਂ ਵੂਡਨ ਨਹੀਂ ਹੈਗਾ ਪੱਕਾ ਪੱਕੇ ਫ਼ਰਸ਼ ਵਾਲਾ ਹੈਗਾ ਜੀ ਹਾਂ ਹਾਂਜੀ ਹਾਂਜੀ ਹਾਂ ਹਾਂਜੀ ਹਾਂ ਸ਼ੂਜ ਵਗੈਰਾ ਪ੍ਰੋਪਰ ਰੱਖੇ ਆ ਹਾਂਜੀ ਹਾਂ

ਨਹੀਂ ਨਹੀਂ ਸੈਨਡੋ ਅਤੇ ਨਿੱਕਰ ਜੀ ਹਾਂਜੀ ਹਾਂ ਪ੍ਰੋ ਬਾਸਕਿਟਬਾਲ 'ਚ ਪਲੈਇੰਗ ਸੈੱਟ 'ਚ ਪੰਜ ਹੁੰਦੇ ਨੇ ਗੇ ਟੀਮ 'ਚ ਬਾਰਾਂ ਹੁੰਦੇ ਨੇ ਜੀ ਹਾਂਜੀ ਸੱਤ ਹੋ ਗਏ ਜੀ ਸਪੇਅਰ ਚੇਂਜ 'ਤੇ ਖੇਡ ਲੈਂਦੇ ਨੇ ਹਾਂਜੀ ਹਾਂ

ਠੀਕ ਹੈ ਜੀ ਧੰਨਵਾਦ ਜੀ ਤੁਹਾਡੇ ਨਾਲ ਦੇ ਠੀਕ ਹੈ ਜੀ ਓਕੇ ਓਕੇ ਜੀ ਧੰਨਵਾਦ